ਹਾਂਜੀ ਮੇਰੀ ਮਨ ਪਸੰਦ ਖੇਡ ਹੈ ਬੈਡਮਿੰਟਨ ਬੈਡਮਿੰਟਨ ਮੈਨੂੰ ਬਹੁਤ ਪਸੰਦ ਹੈ ਇੱਕ ਤਾਂ ਇਹਦੇ ਨਾਲ ਇੱਕ ਗਰਲਸ ਵਾਸਤੇ ਮੈਂ ਵੈਸੇ ਵੀ ਸਮਝਦੀ ਹਾਂ ਕਿ ਬੜੀ ਅੱਛੀ ਗੇਮ ਹੈ ਕਿ ਇਹਦੇ ਨਾਲ ਇੱਕ ਤਾਂ ਬੋਡੀ ਤੁਹਾਡੀ ਕਾਫੀ ਐਕਟਿਵ ਰਹਿੰਦੀ ਹੈ ਔਰ ਬੋਡੀ ਮੂਵਮੈਂਟ ਸਟ੍ਰੈਚ ਵਗੈਰਾ ਜੋ ਵੀ ਹੈ ਤੁਹਾਡਾ ਠੀਕ ਰਹਿੰਦਾ ਲੈਵਲ ਅਤੇ ਇਹਦੇ ਨਾਲ ਖੇਡ ਕੇ ਮੈਨੂੰ ਕਾਫੀ ਖੁਸ਼ੀ ਵੀ ਮਿਲਦੀ ਹੈ ਥੋੜ੍ਹਾ ਟਾਈਮ ਅੱਛਾ ਪਾਸ ਹੋ ਜਾਂਦਾ ਫਿਰ ਆਪਣੇ ਆਪ ਨੂੰ ਐਕਟਿਵ ਐਨਰਜੇਟਿਕ ਅਸੀਂ ਮਹਿਸੂਸ ਕਰਦੇ ਹਾਂ ਅਤੇ ਮੈਨੂੰ ਸ਼ੁਰੂ ਤੋਂ ਹੀ ਬੈਡਮਿੰਟਨ ਹੀ ਪਸੰਦ ਹੈਗੀ ਸੀ ਕਦੀ ਗਲੀਆਂ 'ਚ ਖੇਡ ਲਈ ਕਦੀ ਸਕੂਲ 'ਚ ਖੇਡ ਲਈ ਸਕੂਲ ਤੋਂ ਬਾਅਦ ਕੋਲਜ 'ਚ ਵੀ ਜਦੋਂ ਮੌਕਾ ਮਿਲਦਾ ਸੀ ਵਿੱਚੋਂ ਖੇਡ ਲੈਂਦੇ ਸੀ ਘਰ ਵੀ ਆ ਕੇ ਜਿਸ ਵੇਲੇ ਮੌਕਾ ਮਿਲਦਾ ਅਸੀਂ ਬੈਡਮਿੰਟਨ ਖੇਡ ਲੈਂਦੇ ਹਾਂ ਬੈਡਮਿੰਟਨ ਮੈਨੂੰ ਬਹੁਤ ਪਸੰਦ ਹੈ ਅਤੇ ਉਹ ਅਸੀਂ ਪਾਰਕ 'ਚ ਜਾ ਕੇ ਵੀ ਖੇਡ ਸਕਦੇ ਹਾਂ ਅਤੇ ਮੈਨੂੰ ਹਮੇਸ਼ਾ ਤੋਂ ਇਹ ਹੀ ਹੈ ਕਾਫੀ ਇੰਸਪਾਇਰ ਕਰਦੀ ਰਹੀ ਉਹਨੂੰ ਮੈਨੂੰ ਪੀ ਵੀ ਸਿੰਧੂ ਵੀ ਜਿਹੜੀ ਸਾਡੀ ਹੈਗੀ ਹੈ ਇੰਟਰਨੈਸ਼ਨਲ ਲੈਵਲ 'ਤੇ ਜਿਹਨੇ ਕਿ ਕਾਫੀ ਸਾਨੂੰ ਅ ਮੈਡਲ ਜਿਤਾਏ ਆ ਉਹ ਵੀ ਉਹਨਾਂ ਤੋਂ ਵੀ ਮੈਂ ਕਾਫੀ ਇੰਸਪਾਇਰ ਹੁੰਦੀ ਹਾਂ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਮੈਨੂੰ ਕਿ ਉਹ ਸਾਡੇ ਦੇਸ਼ ਲਈ ਕੁਝ ਕਰ ਰਹੇ ਆ ਅਤੇ ਉਹੀ ਮੈਨੂੰ ਆਪਣੀ ਇਹੀ ਖੇਡ ਜ਼ਿਆਦਾ ਪਸੰਦ ਹੈਗੀ ਹੈ ਔਰ ਲੜਕੀਆਂ ਵਾਸਤੇ ਠੀਕ ਹੈਗੀ ਹੈ ਕਰ ਸਕਦੀਆਂ ਉਹ ਅੱਛੀ ਇਹਦੇ ਵਿੱਚ ਅਤੇ ਕਰਾਟੇ ਇਹ ਵੀ ਠੀਕ ਹੈਗੀ ਹੈ ਪਰ ਫਿਰ ਵੀ ਇਹਦੇ 'ਚ ਇਹ ਹੈਗਾ ਹੈ ਕੀ ਕਰਾਟੇ ਥੋੜ੍ਹੀ ਟੱਫ ਹੈ ਗਰਲਸ ਵਾਸਤੇ ਪਰ ਫਿਰ ਵੀ ਮੈਂ ਚਾਹੁੰਦੀ ਕਿ ਥੋੜ੍ਹੀ ਬਹੁਤੀ ਉਹਨਾਂ ਨੂੰ ਕਰਾਟੇ ਵੀ ਸਿੱਖਣੀ ਚਾਹੀਦੀ ਹੈ ਔਰ ਤੀਰਅੰਦਾਜ਼ੀ ਯੇ ਵੋ ਸਾਡੇ ਦੇਸ਼ ਕਾਫੀ ਕੁਛ ਖੇਡਾਂ 'ਚ ਪਿੱਛੇ ਹੀ ਆ ਪਰ ਉਹਨਾਂ ਨੂੰ ਕੁਛ ਗੇਮਾਂ 'ਚ ਅੱਗੇ ਆਉਣਾ ਚਾਹੀਦਾ ਹੈ